ਬਾਈ ਜੂਨ ਉੱਨੀ ਸੌ ਤਰਾਸੀ ਪੰਜ ਮਈ ਉੱਨੀ ਸੌ ਅੱਠ ਚੌਵੀ ਸਤੰਬਰ ਦੋ ਹਜ਼ਾਰ ਅੱਠ ਸਤਾਰਾਂ ਅਗਸਤ ਉੱਨੀ ਸੌ ਅਠੱਤਰ ਇੱਕ ਜੂਨ ਉੱਨੀ ਸੌ ਚੁਰਾਸੀ